ਹੈਲੋ

ਹਾਂਜੀ ਤੁਸੀਂ ਕੌਣ ਮੈਡਮ ਜੀ ਕੀ ਹੋਇਆ ਉਹ ਤਾਂ ਥੋੜ੍ਹੀ ਦੇਰ ਪਹਿਲੇ ਘਰੋਂ ਠੀਕ ਹੀ ਗਿਆ ਸੀ ਉਹ ਮੈਂ ਗਗਨ ਦੇ ਭਾਪਾ ਨੂੰ ਫੋਨ ਕਰਦੀ ਆ ਉਹ ਉਹਨੂੰ ਨਾ ਸਕੂਲੋਂ ਆ ਕੇ ਲੈ ਜਾਣਗੇ ਥੋੜ੍ਹੀ ਦੇਰ 'ਚ ਹਾਂ ਠੀਕ ਹੈ ਮੈਡਮ ਜੀ ਮੈਂ ਇਹਨਾਂ ਦੇ ਪਾਪਾ ਨੂੰ ਕਹਿੰਦੀ ਆ ਕਿ ਉਹਨੂੰ ਲੈ ਆਉਣ ਠੀਕ ਹੈ ਮੈਡਮ ਜੀ ਮੈਂ ਇਹਨਾਂ ਨੂੰ ਕ ਕਹਾਂਗੀ ਕਿ ਉਹ ਪ੍ਰਿੰਸੀਪਲ ਆਫਿਸ 'ਚ ਉਹਨੂੰ ਲੈ ਲੈਣ ਆ ਜਾਣ ਧੰਨਵਾਦ